ਸਤਿ ਸ਼੍ਰੀ ਅਕਾਲ ਮੇਰਾ ਨਾਮ ਨਵਜੋਤ ਹੈ ਅਤੇ ਮੈਂ ਬਲਾਚੌਰ ਤੋਂ ਗੱਲ ਕਰ ਰਹੀ ਹਾਂ ਦੋ ਕੁ ਘੰਟੇ ਪਹਿਲਾਂ ਮੈਂ ਤੁਹਾਡੀ ਦੁਕਾਨ ਉੱਤੋਂ ਕੇਕ ਦੇ ਨਾਲ ਨਾਲ ਕੋਕ ਬਰਫ਼ੀ ਗੁਲਾਬ ਜਾਮਣ ਅਤੇ ਕੁਛ ਪਕੌੜਿਆਂ ਦਾ ਔਡਰ ਦਿੱਤਾ ਸੀ ਜਿਸ ਦੀ ਮੈਂ ਪੈਮੇਂਟ ਵੀ ਔਨਲਾਇਨ ਕਰ ਚੁੱਕੀ ਹਾਂ ਮੈਂ ਔਡਰ ਦੋ ਕਿਲੋ ਕੇਕ ਦਾ ਕੀਤਾ ਸੀ ਪਰ ਜਿਹੜਾ ਭੇਜਿਆ ਹੋਇਆ ਕੇਕ ਹੈ ਉਹ ਸਿਰਫ਼ ਇੱਕ ਕਿਲੋ ਦਾ ਹੀ ਹੈ ਅਤੇ ਬਰਫ਼ੀ ਦੀ ਜਗ੍ਹਾ ਲੱਡੂ ਭੇਜ ਦਿੱਤੇ ਗਏ ਹਨ ਡੇਢ ਕੁ ਘੰਟੇ ਤੱਕ ਮੇਰੀ ਬਰਡੇ ਪਾਰਟੀ ਸ਼ੁਰੂ ਹੋਣ ਵਾਲੀ ਹੈ ਜਿਸ ਦੇ ਵਿੱਚ ਮੇਰੇ ਬਹੁਤ ਸਾਰੇ ਮਹਿਮਾਨ ਅਤੇ ਮੇਰੇ ਬਹੁਤ ਸਾਰੇ ਦੋਸਤ ਆਉਣ ਵਾਲੇ ਹਨ ਜਿਹਨਾਂ ਨੂੰ ਮੈਂ ਇਹ ਸਭ ਚੀਜ਼ਾਂ ਸਰਵ ਕਰਨੀਆਂ ਨੇ ਪਰ ਔਡਰ ਗਲਤ ਹੋਣ ਕਾਰਨ ਇਹ ਸਭ ਚੀਜ਼ਾਂ ਮੈਂ ਉਹਨਾਂ ਸਾਹਮਣੇ ਸਰਵ ਨਹੀਂ ਕਰ ਪਾਊਂਗੀ ਅਤੇ ਜਿਹੜਾ ਇੱਕ ਕਿਲੋ ਕੇਕ ਹੈ ਉਹ ਵੀ ਸਾਡੇ ਸਭ ਮਹਿਮਾਨਾਂ ਦੇ ਲੀਏ ਘੱਟ ਹੋਵੇਗਾ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਜਲਦੀ ਤੋਂ ਜਲਦੀ ਤੁਸੀਂ ਜਾਂ ਤਾਂ ਔਡਰ ਬਦਲ ਕੇ ਸਹੀ ਔਡਰ ਮੇਰੇ ਘਰ ਭੇਜ ਦਿਓ ਜਾਂ ਫਿਰ ਮੇਰਾ ਜਿਹੜੇ ਪੈਸੇ ਨੇ ਉਹ ਰਿਫੰਡ ਕਰ ਦਿੱਤੇ ਜਾਣ ਤਾਂ ਕਿ ਮੈਂ ਕਿਸੇ ਹੋਰ ਜਗ੍ਹਾ ਤੋਂ ਆਪਣਾ ਔਡਰ ਪਲੇਸ ਕਰ ਸਕਾਂ ਧੰਨਵਾਦ